ਨਹੀਂ ਮੈਂ ਕਿਸੇ ਸਮੂਹ ਦੇ ਨਾਲ ਨਹੀਂ ਦੌੜੀ ਅੱਜ ਤੱਕ ਪਰ ਮੈਂ ਚਾਹੁੰਦੀ ਹਾਂ ਕਿ ਮੈਂ ਦੌੜਾਂ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਨਹਿਰੂ ਯੁਵਾ ਕੇਂਦਰ ਵੱਲੋਂ ਹਰ ਸਾਲ ਮੈਰਾਥੋਨ ਕਰਾਈ ਜਾਂਦੀਆਂ ਅਤੇ ਇਸ ਸਾਲ ਮੈਂ ਚਾਹੁੰਦੀ ਹਾਂ ਕਿ ਉਸ ਵਿੱਚ ਭਾਗ ਲਵਾਂ ਕਿਉਂਕਿ ਮੈਨੂੰ ਦੌੜਨਾ ਬਹੁਤ ਪਸੰਦ ਹੈ ਅਤੇ ਇਸ ਦੇ ਨਾਲ ਨਾਲ ਮੈਨੂੰ ਸਮਾਜ ਦੀ ਸੇਵਾ ਕਰਨੀ ਵੀ ਬਹੁਤ ਪਸੰਦ ਹੈ ਇਸ ਲਈ ਮੈਂ ਇਸ ਵਿੱਚ ਭਾਗ ਲਊਂਗੀ ਅਤੇ ਆਪਣੇ ਆਣ ਵਾਲੇ ਭਵਿੱਖ ਨੂੰ ਸਹੀ ਕਰਾਂਗੀ